ਪੰਜਾਬੀ ਲੋਕ ਆਪਣੀ ਭਾਸ਼ਾ ਦੀ ਵਰਤੋਂ ਦੂਜਿਆਂ ਨਾਲ ਗੱਲਬਾਤ ਕਰਨ ਲਈ ਬਹੁਤ ਹੀ ਮਿੱਠੇ ਸੁਭਾਅ ਨਾਲ ਕਰਦੇ ਹਨ ਉਹ ਵਿੱਚ ਹਿੰਦੀ ਬੋਲਦੇ ਹਨ ਅਤੇ ਵਿੱਚ ਪੰਜਾਬੀ ਵੀ ਬੋਲਦੇ ਹਨ ਉਹ ਬਹੁਤ ਪਿਆਰ ਭਰੀਆਂ ਗੱਲਾਂ ਕਰਦੇ ਹਨ ਤਾਂ ਜੋ ਦੂਸਰਾ ਬੰਦਾ ਉਸ ਦੀ ਗੱਲ ਨੂੰ ਸਮਝ ਸਕੇ ਪੰਜਾਬੀ ਲੋਕ ਬਹੁਤ ਖੁੱਲ੍ਹੇ ਦਿਲ ਦੇ ਅਤੇ ਖੁੱਲ੍ਹੇ ਸੁਭਾਅ ਦੇ ਹੁੰਦੇ ਹਨ ਉਹ ਖਾਣ ਪੀਣ ਦੇ ਬਹੁਤ ਸ਼ੌਕੀਨ ਹੁੰਦੇ ਹਨ ਅਤੇ ਉਹ ਹਰ ਇੱਕ ਨਾਲ ਇੱਕ ਨਾਲ ਹਾਸੀ ਖੁਸ਼ੀ ਗੱਲ ਕਰਦੇ ਹਨ ਅਤੇ ਉਹ ਉਹਨਾਂ ਨੂੰ ਭੰਗੜਾ ਬਹੁਤ ਪਸੰਦ ਹੁੰਦਾ ਹੈ ਅਤੇ ਉਹ ਹਰ ਹਰ ਇਨਸਾਨ ਨਾਲ ਹੱਸ ਕੇ ਖੁੱਲ੍ਹ ਕੇ ਅਤੇ ਮਿਲ ਜੁਲ ਕੇ ਗੱਲ ਕਰਦੇ ਹਨ ਤਾਂ ਜੋ ਹਰ ਇਨਸਾਨ ਉਹਨਾਂ ਨਾਲ ਹੱਸ ਖੇਡ ਕੇ ਖੁੱਲ੍ਹ ਕੇ ਗੱਲ ਕਰ ਸਕੇ